ਮੇਰੀ ਸਭ ਤੋਂ ਸੁੰਦਰ ਯਾਤਰਾ ਇਹ ਸੀ ਕਿ ਜਦੋਂ ਮੈਂ ਪਹਿਲੀ ਵਾਰ ਦੋ ਹਜ਼ਾਰ ਉੱਨੀ ਵਿੱਚ ਕਨੇਡਾ ਜਾਣ ਲਈ ਜਹਾਜ਼ ਵਿੱਚ ਬੈਠੀ ਤਾਂ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਰਹੀ ਹਾਂ ਅਤੇ ਰਸਤੇ ਵਿੱਚ ਜਦੋਂ ਜਹਾਜ਼ ਚਾਈਨਾ ਰੁਕਿਆ ਤਾਂ ਉਹ ਦੇਸ਼ ਵੀ ਦੇਖਣ ਨੂੰ ਮਿਲਿਆ ਇੱਕ ਖਾਸ ਗੱਲ ਇਹ ਸੀ ਕਿ ਜਦੋਂ ਵੱਖ ਵੱਖ ਦੇਸ਼ਾਂ ਦੇ ਲੋਕਾਂ ਵਿੱਚ ਕੋਈ ਸਾਡਾ ਪੰਜਾਬੀ ਦਿਖਾਈ ਦਿੰਦਾ ਤਾਂ ਮਨ ਨੂੰ ਬਹੁਤ ਖੁਸ਼ ਹੁੰਦਾ ਕੋਈ ਆਪਣਾ ਹੀ ਲੱਗਦਾ ਸੀ ਉਸ ਧਰਤੀ 'ਤੇ ਪਹੁੰਚ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਦੂਜੇ ਦੇਸ਼ ਵੀ ਸਾਡੇ ਦੇਸ਼ ਦੀ ਤਰ੍ਹਾਂ ਬਹੁਤ ਸੁੰਦਰ ਹਨ ਪਰ ਇੱਕ ਫਰਕ ਇਹ ਦੇਖਣ ਨੂੰ ਮਿਲਿਆ ਕਿ ਜੋ ਸਾਡੇ ਦੇਸ਼ ਵਿੱਚ ਹੈ ਉਹ ਉੱਥੇ ਨਹੀਂ ਉਹ ਦੇਸ਼ ਵਿੱਚ ਜੋ ਵਧੀਆ ਹੈ ਉਹ ਸਾਡੇ ਦੇਸ਼ ਵਿੱਚ ਨਹੀਂ ਉੱਥੇ ਦੇ ਸਟੋਰਾਂ 'ਤੇ ਜਦੋਂ ਬੱਚਿਆਂ ਨਾਲ ਪਹਿਲੀ ਵਾਰ ਗਈ ਤਾਂ ਸਭ ਕੁਝ ਵੱਖਰਾ ਸੀ ਭਾਰਤ ਦੀ ਤਰ੍ਹਾਂ ਕੋਈ ਰੇਹੜੀ ਵਾਲਾ ਜਾਂ ਕਬਾੜ ਵਾਲਾ ਦਿਖਾਈ ਨਹੀਂ ਸੀ ਦੇ ਰਿਹਾ ਇਹ ਰੌਣਕ ਦੇਖਣ ਨੂੰ ਨਹੀਂ ਮਿਲੀ ਫਿਰ ਜਦੋਂ ਉੱਥੇ ਦੇ ਗੁਰੂ ਘਰ ਗਈ ਤਾਂ ਬਹੁਤ ਸਕੂਨ ਮਿਲਿਆ ਜਿਵੇਂ ਪੰਜਾਬ ਵਿੱਚ ਹੀ ਬੈਠੇ ਹੋਈਏ ਪਰ ਇੱਕ ਘਾਟ ਜ਼ਰੂਰ ਲੱਗੀ ਕਿ ਉਹ ਕੋਈ ਵੀ ਦਿਨ ਤਿਉਹਾਰ ਸੇਮ ਤਰੀਕ ਨੂੰ ਨਹੀਂ ਮਨਾਉਂਦੇ ਅੱਗੇ ਪਿੱਛੇ ਮਨਾਉਂਦੇ ਹਨ ਤਕਰੀਬਨ ਐਤਵਾਰ ਨੂੰ ਜਿਸ ਦਿਨ ਵੀ ਮਨਾਉਂਦੇ ਹਨ ਬਹੁਤ ਵਧੀਆ ਸਲੀਕੇ ਨਾਲ ਮਨਾਉਂਦੇ ਹਨ ਚਾਹੇ ਉਹ ਗੁਰਪੁਰਬ ਹੋਵੇ ਜਾਂ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਉਂਦੇ ਨੇ ਉੱਥੇ ਦੇ ਲੋਕ ਵੀ ਜਦੋਂ ਹਾਜਰੀ ਭਰਦੇ ਨੇ ਤਾਂ ਬੜਾ ਵਧੀਆ ਲੱਗਦਾ ਹੈ ਸਾਨੂੰ ਮਾਣ ਹੁੰਦਾ ਹੈ ਕਿ ਸਾਡੇ ਗੁਰੂਆਂ ਦਾ ਇਤਿਹਾਸ ਇਹ ਲੋਕ ਵੀ ਜਾਣਦੇ